ਗਊ ਡੰਗ ਦੀ ਵਰਤੋਂ ਕੱਚੇ ਘਰਾਂ ਵਿੱਚ ਕੀਤੀ ਜਾਂਦੀ ਸੀ ਪਰ ਅੱਜ ਕੱਲ੍ਹ ਤਾਂ ਕੱਚੇ ਘਰ ਨਹੀਂ ਰਹਿ ਗਏ ਪੱਕੇ ਫਰਸ਼ ਆ ਗਏ ਨੇ ਇਸ ਲਈ ਕ ਗਊ ਡੰਗ ਦੀ ਵਰਤੋਂ ਵੀ ਬਹੁਤ ਘੱਟ ਗਈ ਹੈ ਅਤੇ ਇਹ ਸਿਹਤ ਲਈ ਲਾਭਦਾਇਕ ਹੁੰਦੇ ਹਨ ਕਿਉਂਕਿ ਗਊ ਡੰਗ ਕਰਨ ਤੋਂ ਬਾਅਦ ਫਰਸ਼ ਠੰਡੇ ਅਤੇ ਵਧੀਆ ਰਹਿੰਦੇ ਹਨ